ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਜਗ੍ਹਾ ਹਨ ਜੋ ਕਿ ਔਫਬੀਟ ਹਨ ਜਿਨ੍ਹਾਂ ਬਾਰੇ ਸੈਲਾਨੀਆਂ ਨੂੰ ਬਹੁਤ ਹੀ ਘੱਟ ਜਾਣਕਾਰੀ ਹੈ ਜਿਨ੍ਹਾਂ ਵਿੱਚੋਂ ਇੱਕ ਤਾਂ ਬਾਬਾ ਬੰਦਾ ਸਿੰਘ ਬਹਾਦੁਰ ਦੀਆਂ ਗੁਫਾਵਾਂ ਇਹ ਗੁਫਾਵਾਂ ਬਾਰੇ ਲੋਕਾਂ ਨੂੰ ਬਹੁਤ ਹੀ ਘੱਟ ਪਤਾ ਹੈ ਪਰ ਇਹ ਬਹੁਤ ਹੀ ਇਤਿਹਾਸਿਕ ਅਤੇ ਦੇਖਣ ਯੋਗ ਗੁ ਗੁਫਾਵਾਂ ਹਨ ਸੈਲਾਨੀਆਂ ਦੇ ਲਈ ਇਸ ਤੋਂ ਇਲਾਵਾ ਕਿੱਕਰ ਲੌਜ ਵੀ ਹੈ ਜੋ ਕਿ ਬਹੁਤ ਹੀ ਵਧੀਆ ਜਗ੍ਹਾ ਹੈ ਸੈਲਾਨੀਆਂ ਦੇ ਲਈ ਪਰ ਸੈਲਾਨੀਆਂ ਨੂੰ ਇਸ ਦੇ ਬਾਰੇ ਬਹੁਤ ਹੀ ਘੱਟ ਪਤਾ ਹੈ